ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ

ਬਾਕੀ ਸਾਰਾ ਤਾ ਠੀਕ ਹੈ ਜੀ ਉਹਦਾ ਮੈਥ ਦਾ ਜਿਹੜਾ ਲਿਆ ਸੀ ਟੈਸਟ ਉਹਦੇ 'ਚ ਉਹਦੇ ਨੰਬਰ ਘੱਟ ਚੱਲ ਰਹੇ ਹਨ ਹਾਂਜੀ ਉਹਨੂੰ ਕਹੋ ਵੀ ਮਾੜੀ ਮੋਟੀ ਮਿਹਨਤ ਕਰਿਆ ਕਰੇ ਘਰੇ ਜਾ ਕੇ ਜਮਾ ਹੀ ਨਹੀਂ ਉਹ ਮੈਥ ਦੀ ਕਿਤਾਬ ਖੋਲਦਾ ਬਾਕੀ ਇਹਦਾ ਵਧੀਆ ਮੇਨ ਸਬਜੈਕਟ ਏ ਮੈਥ ਔਰ ਇੰਗਲਿਸ਼ ਹੁੰਦੇ ਆ ਉਹ ਮੈਥ 'ਚ ਏ ਪਿੱਛੇ ਚੱਲ ਰਿਹਾ ਹਾਂਜੀ ਕਿ ਸਾਰੀ ਜ਼ਿੰਦਗੀ ਆ ਹੀ ਹਿਸਾਬ ਕਿਤਾਬ ਦੀ ਲੋੜ ਹੈ ਉਹ ਉਸ 'ਚ ਪਿੱਛੇ ਚੱਲ ਰਿਹਾ ਫਿਰ ਕਿਵੇਂ ਚੱਲ ਸਕਦਾ ਅਟੈਂਡਸ ਆਉਂਦਾ ਤਾਂ ਠੀਕ ਆ ਵਿੱਚ ਵਿੱਚ ਕਈ ਵਾਰ ਬੰਕ ਮਾਰ ਜਾਂਦਾ ਜੀ ਮੁੰਡਿਆਂ ਨਾਲ ਘੁੰਮ ਘੁੰਮ ਹੁਣ ਉਹ ਸਾਨੂੰ ਕੀ ਪਤਾ ਜੀ ਉਹ ਘਰੋਂ ਹੀ ਨਹੀਂ ਆਉਂਦਾ ਜਾਂ ਉਹ ਲੰਘ ਜਾਂਦਾ ਬਾਹਰ ਘੁੰਮਣ ਮੁੰਡਿਆਂ ਨਾਲ ਇਹ ਤਾਂ ਤੁਸੀਂ ਵਿੱਚ ਵਿਚ ਪੈਰਵਾਈ ਰੱਖਣੀ ਕਿਸੇ ਰਿਸ਼ਤੇਦਾਰ ਨੂੰ ਕਹਿ ਕੇ ਰੱਖੋ ਵਿੱਚ ਵਿੱਚ ਉਰੇ ਗੇੜਾ ਮਾਰ ਕੇ ਦੇਖ ਕੇ ਜਾਵੇ ਇਹਨੂੰ ਭਾਵੇਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਕਹਿ ਦੋ ਜਿਹੜਾ ਨੇੜੇ ਤੇੜੇ ਹੋਵੇ ਉਹ ਹਾਂ ਅਗਲੀ ਪੇਰੈਂਟ ਟੀਚਰ ਮੀਟਿੰਗ 'ਚ ਤੁਸੀਂ ਜ਼ਰੂਰ ਆਉਣਾ ਵੀ ਇਸ ਤੋਂ ਬਾਅਦ ਤਾਂ ਇਵੇਂ ਫੋਨ 'ਤੇ ਗੱਲ ਨਹੀਂ ਜ਼ਿਆਦਾ ਹੁੰਦੀ ਸਤਿ ਸ਼੍ਰੀ ਅਕਾਲ ਜੀ